ਪੰਜਾਬ ਦੇ ਵਿੱਚ ਸਮ ਮੌਸਮ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ ਇਹਨਾਂ ਨੂੰ ਮੁੱਖ ਤੌਰ 'ਤੇ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ ਹਾੜ੍ਹੀ ਦੀਆਂ ਫਸਲਾਂ ਅਤੇ ਸਾਉਣੀ ਦੀਆਂ ਫਸਲਾਂ ਹਾੜ੍ਹੀ ਦੀਆਂ ਫਸਲਾਂ ਉਹ ਹੁੰਦੀਆਂ ਹਨ ਜਿਹੜੀਆਂ ਗਰਮੀਆਂ ਵੇਲੇ ਹੁੰਦੀਆਂ ਹਨ ਜਿਵੇਂ ਕਣਕ ਜੌਂ ਮੱਕੀ ਦਾਲਾਂ ਜਿਵੇਂ ਮੂੰਗੀ ਮਸਰੀ ਅਤੇ ਹੋਰ ਕਈ ਕਿਸਮ ਦੀਆਂ ਦਾਲਾਂ ਜਿਹੜੀ ਉਹਨਾਂ ਦੀ ਸੂਰਜਮੁਖੀ ਅਤੇ ਹੋਰ ਵੀ ਕਈ ਕਿਸਮ ਦੀਆਂ ਦਾਲਾਂ ਜਿਹੜੀ ਸ ਬੀਜਾਈ ਕੀਤੀਆਂ ਇਸ ਤੋਂ ਬਿਨਾਂ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਵਿੱਚ ਸ਼ਿਮਲਾ ਮਿਰਚ ਕਰੇਲੇ ਅਤੇ ਘਈਆ ਮਿੱਠਾ ਕੱਦੂ ਭਿੰਡੀ ਤੋਰੀ ਰਾਮ ਤੋਰੀ ਫਲੀਆਂ ਬੈਂਗਣ ਅਰਬੀ ਅਤੇ ਆਲੂ ਹੋਰ ਵੀ ਕਈ ਕਿਸਮ ਦੀ ਅਲ ਜਿਹੜੀ ਖੇਤੀ ਆ ਗਰਮੀਆਂ ਦੇ ਵਿੱਚ ਸਾਉਣੀ 'ਚ ਕੀਤੀ ਜਾਂਦੀ ਅ ਹਾੜ੍ਹੀ 'ਚ ਕੀਤੀ ਜਾਂਦੀ ਹੈ ਇਸ ਤੋਂ ਬਿਨਾਂ ਦੂਸਰਾ ਸੀਜ਼ਨ ਆ ਜਿਹੜਾ ਉਹ ਸਾਉਣੀ ਦਾ ਸੀਜ਼ਨ ਗਿਣਿਆ ਜਾਂਦਾ ਹੈ ਜਿਹਦੇ ਵਿੱਚ ਜ਼ਿਆਦਾਤਰ ਜੀਰੀ ਗੰਨਾ ਸਰ੍ਹੋਂ ਮੱਕੀ ਛੋਲੇ ਆਲੂ ਇਹ ਤਾਂ ਮੇਨ ਫਸਲਾਂ ਨੇ ਇਸ ਤੋਂ ਬਿਨਾਂ ਸਰਦੀ ਦੇ ਵਿੱਚ ਸਬਜ਼ੀਆਂ ਜਿਵੇਂ ਗਾਜਰ ਮਟਰ ਗੋਭੀ ਬੰਦ ਗੋਭੀ ਫੁੱਲ ਗੋਭੀ ਪਾਲਕ ਧਨੀਆ ਜਿਮੀਕੰਦ ਹਰੀ ਮਿਰਚ ਆਦਿ ਦੀ ਵੀ ਖੇਤੀ ਕੀਤੀ ਜਾਂਦੀ ਹੈ ਇਸ ਤੋਂ ਬਿਨਾਂ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਹੋਰ ਵੀ ਕਈ ਕਿਸਮ ਦੀਆਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ